ਭਾਰਤ ਦੇ ਬਟਵਾਰਾ ਦੇ ਬਾਅਦ ਬਹੁਤ ਦੰਗੇ ਫਸਾਦ ਹੋਏ ਜਿਸ ਕਰਕੇ ਉਹਨਾਂ ਵਿੱਚ ਮਾਸੂਮ ਔਰਤਾਂ ਮਾਸੂਮ ਬੱਚਿਆਂ ਮਾਸੂਮ ਉਹ ਲੋਕਾਂ ਨੂੰ ਮੌਤ ਦਾ ਸਾਹਮਣਾ ਕਰਨਾ ਪਿਆ ਅਤੇ ਮੁਸ਼ਕਲਾਂ ਦੀ ਸਾਹਮਣਾ ਕਰਨਾ ਪਿਆ ਉਸ ਵਿੱਚ ਕੁਛ ਗ਼ਲਤ ਲੋਕਾਂ ਦੇ ਕਾਰਨ ਇਹ ਦਿਨ ਦੇਖਣੇ ਪਏ ਕਿ ਉਹਨਾਂ ਵਿੱਚ ਦੰਗੇ ਫਸਾਦ ਹੋਰ ਵੀ ਵੱਧ ਗਿਆ ਬਟਵਾਰੇ ਦੇ ਬਾਅਦ ਸਿੱਖਾਂ ਮੁਸਲਮਾਨਾਂ ਹਿੰਦੂਆਂ ਅਤੇ ਇਨ੍ਹਾਂ ਵਿੱਚ ਅਲੱਗ ਅਲੱਗ ਜਗ੍ਹਾ ਅਤੇ ਹਰ ਦਿਨ ਲੜਾਈ ਚੱਲਦੀ ਰਹੀ ਲੜਾਈ ਦਾ ਪਹਿਲੇ ਬਹੁਤ ਹੀ ਬ ਪਹਿਲਾਂ ਬਹੁਤ ਹੀ ਭਾਈਚਾਰਾ ਹੋਣ ਦੇ ਕਰ ਕਾਰਨ ਉਹਨਾਂ ਨੂੰ ਲ ਲੜਨਾ ਪਿਆ ਜਿਸ ਕਰਕੇ ਪਾਕਿਸਤਾਨ ਵਿੱਚ ਅਤੇ ਭਾਰਤ ਪਾਕਿਸਤਾਨ ਵਿੱਚ ਬਟਵਾਰਾ ਹੋ ਗਿਆ ਪਾਕਿਸਤਾਨ ਦੇ ਲੋਕ ਭਾਰਤ ਵਿੱਚ ਹੁਣ ਆ ਨਹੀਂ ਸਕਦੇ ਕਿਉਂਕਿ ਉਹ ਇਸ ਮੁਲਕ ਦੇ ਨਹੀਂ ਹਨ ਉਹਨਾਂ ਨੂੰ ਆਉਣ ਲਈ ਇੱਥੇ ਦੀ ਵੀਜ਼ਾ ਚਾਹੀਦਾ ਹੁਣ ਚਾਹੀਦਾ ਹੈ ਤਾਂ ਹੀ ਉਹ ਇਸ ਮੁਲਕ ਵਿੱਚ ਐਂਟਰ ਕਰ ਸਕਦੇ ਨੇ